ਸਾਡੇ ਖੇਤਰ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਿਵੇਂ ਪੰਜਾਬੀ ਹਿੰਦੀ ਅੰਗਰੇਜ਼ੀ ਸੰਸਕ੍ਰਿਤ ਆਦਿ ਲੋਕ ਕੰਮ ਕਰਨ ਦੇ ਸਮੇਂ ਆਪਣੀ ਮਾਤ ਭਾਸ਼ਾ ਨੂੰ ਜ਼ਿਆਦਾਤਰ ਤਰਜੀਹ ਦਿੰਦੇ ਨੇ ਜਿਹੜੇ ਨੌਜਵਾਨ ਨੇ ਜ਼ਿਆਦਾਤਰ ਆਪਣੀ ਮਾਂ ਬੋਲੀ ਦੇ ਵਿੱਚ ਗੱਲ ਕਰਨ ਸਮੇਂ ਮਾਣ ਮਹਿਸੂਸ ਕਰਦੇ ਨੇ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਜਦੋਂ ਅਸੀਂ ਆਪਣੀ ਮਾਂ ਬੋਲੀ ਦੇ ਵਿੱਚ ਗੱਲ ਕਰਦੇ ਹਾਂ ਮਾਂ ਬੋਲੀ ਦੇ ਵਿੱਚ ਨਾ ਕੋਈ ਹਿਚਕਚਾਹਟ ਨਾ ਕੋਈ ਝਿਜਕ ਪਤਾ ਨਹੀਂ ਕਿੱਥੋਂ ਵਿਚਾਰ ਆਈ ਜਾਂਦੇ ਨੇ ਮਾਂ ਬੋਲੀ ਸਾਡੀ ਮਾਂ ਬੋਲੀ ਦੇ ਵਿੱਚ ਹੀ ਐਨੀ ਜ਼ਿਆਦਾ ਸ਼ਕਤੀ ਹੁੰਦੀ ਹੈ ਜੇ ਆਪਾਂ ਆਪਣੀ ਮਾਂ ਬੋਲੀ ਦੇ ਵਿੱਚ ਕੁਛ ਵੀ ਕਰ ਲਈਏ ਕੋਈ ਕੋਰਸ ਕਰ ਲਈਏ ਆਪਣੀ ਮਾਂ ਬੋਲੀ ਦੇ ਵਿੱਚ ਇੰਨੀ ਜ਼ਿਆਦਾ ਸ਼ਕਤੀ ਹੁੰਦੀ ਆ ਉਹ ਆਪਾਂ ਨੂੰ ਆਪ ਹੀ ਅੱਗੇ ਤੋਰੀ ਜਾਂਦੀ ਹੈ ਪਤਾ ਨਹੀਂ ਉਹ ਕਿੱਥੋਂ ਉਸ ਦੁਆਰਾ ਸ਼ਕਤੀ ਲੱਗਦੀ ਹੈ ਕਿ ਆਪਾਂ ਮਾਂ ਬੋਲੀ ਦੇ ਵਿੱਚ ਲੱਗ ਜਾਈਏ ਜੇਕਰ ਆਪਾਂ ਕਿਸੇ ਦੂਜੀ ਭਾਸ਼ਾ ਦੇ ਵਿੱਚ ਆਪਾਂ ਨੇ ਕਿਤੇ ਭਾਸ਼ਣ ਦੇਣਾ ਹੋਵੇ ਤਾਂ ਆਪਾਂ ਨੂੰ ਸੋਚ ਸੋਚ ਕੇ ਬੋਲਣਾ ਪੈਂਦਾ ਹਿਚਕਾ ਕੇ ਬੋਲਣਾ ਪੈਂਦਾ ਜਦੋਂ ਆਪਾਂ ਕਿਸ ਮਾਂ ਬੋਲੀ 'ਤੇ ਲੱਗ ਜਾਈਏ ਤਾਂ ਆਪਾਂ ਨੂੰ ਇੱਕ ਟੋਪਿਕ ਇੱਕ ਦਿੱਤਾ ਜਾਂਦਾ ਆਪਾਂ ਉਹ ਟੋਪਿਕ ਦੇ ਦਸ ਟੋਪਿਕ ਹੋਰ ਬਣਾ ਦਿੰਦੇ ਹਾਂ ਕਿਉਂਕਿ ਮਾਂ ਬੋਲੀ ਆਪਣੇ ਇਸ ਰੋਮ ਰੋਮ ਵਿੱਚ ਵਸੀ ਹੋਣ ਕਰਕੇ ਆਪਾਂ ਇਹਦੇ 'ਚ ਹਿਚਕਚਾਹਟ ਨਹੀਂ ਕਰ ਸਕਦੇ ਇਸ ਲਈ ਸਾਨੂੰ ਮਾਂ ਬੋਲੀ ਦੇ ਉੱਪਰ ਬੋਲਣਾ ਸਾਡੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ